ਹੁਣੇ ਹੀ ਸਿੱਖਣ ਵਾਲੇ ਵਿਅਕਤੀ ਲਈ ਤੈਰਨ ਲਈ ਮੇਰੀ ਇਹ ਸਲਾਹ ਹੈ ਕਿ ਉਸਨੂੰ ਅਪ ਘੱਟ ਡੂੰਘੇ ਪਾਣੀ ਵਾਲੇ ਤਲਾਅ ਵਿੱਚ ਟਰਾਈ ਕਰਨਾ ਚਾਹੀਦਾ ਹੈ ਉਸਨੂੰ ਆਪਣੀ ਹਾਈਟ ਦੇ ਹਿਸਾਬ ਨਾਲ ਪਾਣੀ ਦੀ ਡੂੰਘਾਈ ਦੇਖਣੀ ਚਾਹੀਦੀ ਹੈ ਤਾਂ ਕਿ ਕੋਈ ਦੁਰਘਟਨਾ ਨਾ ਹੋਵੇ ਸ਼ੁਰੂ ਦੇ ਵਿੱਚ ਉਸਨੂੰ ਕਿਸੇ ਦੀ ਨਿਗਰਾਨੀ ਹੇਠ ਤੈਰਨਾ ਸਿੱਖਣਾ ਚਾਹੀਦਾ ਹੈ ਤੈਰਨ ਦੇ ਸਮੇਂ ਉਸਨੂੰ ਜ਼ਿਆਦਾ ਲੂਜ ਕੱਪੜੇ ਨਹੀਂ ਪਹਿਨਣੇ ਚਾਹੀਦੇ

ਉਸਨੂੰ ਤੈਰਨ ਲਈ ਹਰ ਵਿਧੀ ਸਿੱਖਣੀ ਚਾਹੀਦੀ ਹੈ ਜਿਸ ਨਾਲ ਕੋਈ ਹਾਦਸਾ ਵਗੈਰਾ ਨਾ ਹੋ ਸਕੇ